ਮੇਰੇ ਘਰ ਮੇਰਾ ਘਰ ਇੱਕ ਪਿੰਡ ਵਿੱਚ ਹੈ ਅਤੇ ਉਸ ਪਿੰਡ ਦੇ ਵਿੱਚ ਬਹੁਤ ਸਾਰੇ ਪੰਛੀ ਇੱਧਰ ਉੱਧਰ ਉੱਡਦੇ ਨਜ਼ਰ ਆਉਂਦੇ ਹਨ ਲੇਕਿਨ ਕਈ ਵਾਰ ਉਹ ਪੰਛੀ ਘਰਾਂ ਵਿੱਚ ਵੀ ਆ ਜਾਂਦੇ ਹਨ ਇੱਕ ਵਾਰੀ ਇੱਕ ਚਿੜੀ ਨੇ ਸਾਡੇ ਘਰ ਵਿੱਚ ਆਲ੍ਹਣਾ ਬਣਾਇਆ ਅਤੇ ਬਹੁਤ ਦਿਨਾਂ ਤੱਕ ਉਸ ਆਲ੍ਹਣੇ ਵਿੱਚ ਉਸ ਨੇ ਆਂਡੇ ਦਿੱਤੇ ਫਿਰ ਉਹਦੇ ਵਿੱਚ ਛੋਟੇ ਛੋਟੇ ਬੱਚੇ ਪੈਦਾ ਹੋਏ ਫਿਰ ਉਹ ਉਹਨਾਂ ਨੂੰ ਚਿੜੀ ਉਹਨਾਂ ਨੂੰ ਚੋਗਾ ਚੁਗਾਂਦੀ ਹੁੰਦੀ ਸੀ ਇਹ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਸੀ ਮੈਂ ਵੀ ਛੋਟੀ ਸੀ ਅਤੇ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਮੈਨੂੰ ਬੜੀ ਹੀ ਖੁਸ਼ੀ ਮਹਿਸੂਸ ਹੁੰਦੀ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨਾਂ ਨੂੰ ਪਕੜ ਲਵਾਂ ਜੇਕਰ ਮੇਰੀ ਮੰਮੀ ਨੇ ਕਿਹਾ ਕਿ ਇਹਨਾਂ ਛੋਟੇ ਬੱਚਿਆਂ ਨੂੰ ਹੱਥ ਨਹੀਂ ਲਾਈਦਾ ਕਿਉਂਕਿ ਇਹ ਛੋਟੇ ਬੱਚੇ ਬਹੁਤ ਹੀ ਨਾਜ਼ੁਕ ਹੁੰਦੇ ਹਨ ਇੱਕ ਵਾਰ ਜੇ ਸਾਡੇ ਕੋਲੋਂ ਇਹ ਨੀਚੇ ਗਿਰ ਗਏ ਤਾਂ ਫਿਰ ਇਹ ਆਪਣੀ ਉਡਾਨ ਨਹੀਂ ਭਰ ਸਕਣਗੇ ਇਸ ਲਈ ਇਹਨਾਂ ਨੂੰ ਹੱਥ ਨਹੀਂ ਲਗਾਣਾ ਚਾਹੀਦਾ ਇਹਨਾਂ ਨੂੰ ਬੜੇ ਹੀ ਆਰਾਮ ਨਾਲ ਬੜੇ ਹੀ ਪਿਆਰ ਨਾਲ ਇਹਨਾਂ ਨੂੰ ਦੇਖਦੇ ਰਹਿਣਾ ਚਾਹੀਦਾ ਹੈ ਕਿ ਉਹ ਬਹੁਤ ਹੀ ਸੁੰਦਰ ਅਤੇ ਪਿਆਰੇ ਹਨ ਅਸੀਂ ਅਸੀਂ ਉਹਨਾਂ ਨੂੰ ਵੱਡੇ ਹੁੰਦਿਆਂ ਦੇਖਿਆ ਅਤੇ ਬਾਅਦ ਵਿੱਚ ਉਹ ਚਿੜੀ ਉਹਨਾਂ ਨੂੰ ਲੈ ਕੇ ਉੱਡ ਗਈ ਅਤੇ ਉਹ ਜਾ ਕੇ ਬ ਛੋਟੇ ਛੋਟੇ ਬੱਚੇ ਵੀ ਵੱਡੇ ਹੋ ਗਏ ਅਤੇ ਬਾਅਦ ਵਿੱਚ ਉਡਾਰੀ ਮਾਰ ਕੇ ਉੱਥੋਂ ਆਪਣਾ ਆਲ੍ਹਣਾ ਖਾਲੀ ਕਰਕੇ ਚਲੇ ਗਏ ਧੰਨਵਾਦ